ਮੈਂ ਇੱਕ ਔਨਲਾਈਨ 'ਤੇ ਜੈਕਟ ਦੇਖੀ ਅਤੇ ਫੇਰ ਮੈਂ ਉਸ ਨੂੰ ਖਰੀਦਿਆ ਸੀ ਉਹ ਜੈਕਟ ਮੈਨੂੰ ਥੋੜ੍ਹੀ ਵੱਡੀ ਸੀ ਜੈਕਟ ਵੱਡੀ ਹੋਣ ਕਾਰਨ ਮੈਂ ਫਿਰ ਫਲਿੱਪਕਾਰਡ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਡੀ ਜੈਕਟ ਐਕਸਚੇਂਜ ਹੋ ਜਾਵੇਗੀ ਫਿਰ ਮੈਂ ਆ ਆਪਦੀ ਜੈਕਟ ਐਕਸਚੇਂਜ ਕਰਨ ਵਾਸਤੇ ਭੇਜ ਦਿੱਤੀ ਫਿਰ ਮੈਂ ਆਪਦੀ ਜੈਕਟ ਨੂੰ ਟਰੈਕ ਕੀਤਾ ਮੇਰੀ ਜੈਕਟ ਕਿੱਥੇ ਤੱਕ ਪਹੁੰਚ ਗਈ ਹੈ ਫਿਰ ਮੈਂ ਜਦੋਂ ਦੁਬਾਰਾ ਚੈੱਕ ਕੀਤਾ ਮੇਰੀ ਜੈਕਟ ਬਲੂ ਗੋਗਲ ਵਾਲਾ ਕੋਲ ਪਹੁੰਚ ਚੁੱਕੀ ਸੀ ਉਹਨਾਂ ਨੇ ਮੈਨੂੰ ਕਿਹਾ ਤੁਹਾਡੀ ਜੈਕਟ ਦੋ ਦਿਨ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਵੇਗੀ